ਮੈਂ ਆਪਣੇ ਰੋਜ਼ਾਨਾ ਜੀਵਨ ਵਿੱਚ ਆਪਣੇ ਕੋਲਜ ਦੀ ਲਾਇਬ੍ਰੇਰੀ ਦਾ ਇਸਤੇਮਾਲ ਕਰਦੀ ਹਾਂ ਮੈਨੂੰ ਕਿਤਾਬਾਂ ਪੜ੍ਹਨੀਆਂ ਬਹੁਤ ਹੀ ਜ਼ਿਆਦਾ ਪਸੰਦ ਹਨ ਇਸ ਕਰਕੇ ਮੈਂ ਆਪਣੇ ਪੂਰੇ ਦਿਨ 'ਚੋਂ ਕੁਛ ਸਮਾਂ ਕੱਢ ਕੇ ਲਾਇਬ੍ਰੇਰੀ ਵਿੱਚ ਜਾਂਦੀ ਹਾਂ ਅਤੇ ਆਪਣੀਆਂ ਮਨਪਸੰਦ ਕਿਤਾਬਾਂ ਪੜ੍ਹਦੀ ਹਾਂ ਕਿਤਾਬਾਂ ਪੜ੍ਹਣ ਨਾਲ ਸਾਨੂੰ ਬਹੁਤ ਕੁਛ ਵਧੀਆ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਮੈਂ ਆਪਣੇ ਪੂੂਰੇ ਟਾਈਮ ਵਿੱਚੋਂ ਕੁਛ ਸਮਾਂ ਅਪਣੇ ਲਈ ਜ਼ਰੂਰ ਕੱਢਦੀ ਹਾਂ ਜਦੋਂ ਕਿ ਮੈਂ ਕੁਛ ਕਿਤਾਬਾਂ ਨਾਲ ਆਪਣਾ ਸਮਾਂ ਬਿਤਾ ਕੇ ਨਵਾਂ ਸਿੱਖਦੀ ਹਾਂ ਮੈਨੂੰ ਕਿਤਾਬਾਂ ਪੜ੍ਹਣਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਮੇਰੇ ਘਰ ਵਿੱਚ ਮੇਰੀ ਕੋਈ ਵੀ ਲਾਇਬ੍ਰੇਰੀ ਨਹੀਂ ਹੈ ਸਾਡੇ ਘਰ ਵਿੱਚ ਇੰਨੀ ਜਗ੍ਹਾ ਨਾ ਹੋਣ ਕਰਕੇ ਮੈਂ ਆਪਣੀ ਇੱਕ ਲਾਇਬ੍ਰੇਰੀ ਨਹੀਂ ਬਣਾ ਸਕਦੀ ਪਰ ਫਿਰ ਵੀ ਮੈਂ ਆਪਣੇ ਘਰ ਵਿੱਚ ਇੱਕ ਕੋਨੇ ਵਿੱਚ ਜਗ੍ਹਾ 'ਤੇ ਆਪਣੀਆਂ ਕਿਤਾਬਾਂ ਰੱਖੀਆਂ ਹਨ ਜੋ ਕਿ ਇੱਕ ਛੋਟੀ ਜਿਹੀ ਲਾਇਬ੍ਰੇਰੀ ਵਾਂਗ ਹੈ ਜਿੱਥੇ ਮੈਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਜੋ ਕਿ ਮੈਨੂੰ ਪੜ੍ਹਣੀਆਂ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਹਨ ਉਹ ਰੱਖੀਆਂ ਹਨ ਮੈਂ ਆਪਣਾ ਵੱਧ ਸਮਾਂ ਉਹਨਾਂ ਨਾਲ ਬਿਤਾਉਂਦੀ ਹਾਂ ਅਤੇ ਉਹਨਾਂ ਨੂੰ ਪੜ੍ਹਦੀ ਹਾਂ ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ 'ਤੇ ਬੈਠ ਕੇ ਮੈਂ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੀ ਹਾਂ ਅਤੇ ਆਪਣੇ ਆਪ ਨਾਲ ਸਮਾਂ ਬਿਤਾਉਂਦੀ ਹਾਂ ਉਹ ਲਾਇਬ੍ਰੇਰੀ ਬਹੁਤ ਹੀ ਛੋਟੀ ਜੀ ਹੈ ਪਰ ਮੈਨੂੰ ਉੱਥੇ ਵੀ ਬਹੁਤ ਸਕੂਨ ਮਿਲਦਾ ਹੈ ਮੈਂ ਚਾਹੁੰਦੀ ਹਾਂ ਕਿ ਅੱਗੇ ਜਾ ਕੇ ਮੈਂ ਇੱਕ ਬਹੁਤ ਹੀ ਸੋਹਣੀ ਆਪਣੇ ਘਰ ਵਿੱਚ ਆਪਣੀ ਲਾਇਬ੍ਰੇਰੀ ਬਣਾਵਾਂ ਜਿੱਥੇ ਕਿ ਮੈਂ ਬਹੁਤ ਸਾਰੀਆਂ ਆਪਣੇ ਪਸੰਦਦਾਰ ਕਿਤਾਬਾਂ ਰੱਖੀਆਂ ਹੋਣ ਧੰਨਵਾਦ